ਸਾਡੇ ਪੰਜਾਬ ਵਿੱਚ ਜ਼ਿਆਦਾਤਰ ਅੱਜ ਕੱਲ੍ਹ ਦੇ ਜਿਹੜੇ ਨਿਊ ਜਨਰੇਸ਼ਨ ਹੈ ਉਹ ਰੀਡੇਮੈਂਟ ਕਲੋਥਜ਼ ਨੂੰ ਜ਼ਿਆਦਾ ਪ੍ਰੈਫ਼ਰ ਕਰਦੀ ਹਾ ਬਟ ਜਿਹੜੇ ਹੈਡਮੇਡ ਕਲੋਥਜ਼ ਹੁੰਦੇ ਹਨ ਉਹ ਜ਼ਿਆਦਾ ਬੈਸਟ ਕੋਆਲਿਟੀ ਦੇ ਅਤੇ ਲੌਂਗ ਟਾਈਮ ਚੱਲਣ ਆਲੇ ਕੱਪੜੇ ਹੁੰਦੇ ਹਨ ਅਤੇ ਜਿਹੜੇ ਓਲਡ ਜਨਰੇਸ਼ਨ ਦੇ ਲੋਕ ਆ ਉਹ ਮੋਸਟਲੀ ਹੌਮਮੇਡ ਕਲੋਥਜ਼ ਨੂੰ ਹੀ ਪ੍ਰੈਫ਼ਰ ਕਰਦੇ ਹਨ ਕਿਉਂਕਿ ਉਹ ਲੌਂਗ ਟਾਈਮ ਚੱਲਦੇ ਹੈ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ਼ ਉਹਨੂੰ ਸਿਲਾਈ ਕਢਾਈ ਕੀਤਾ ਜਾਂਦਾ ਹੈ ਜਿਹੜੇ ਅਸੀਂ ਰੇਡੀਮੇਡ ਕਲੋਥਜ਼ ਲੈਂਦੇ ਹਾਂ ਸਾਨੂੰ ਨੀ ਪਤਾ ਉਹ ਕਿਵੇਂ ਤਿਆਰ ਕੀਤੇ ਗਏ ਹੈ ਕਦੋਂ ਫਟ ਜੇ ਕਦੋਂ ਕੀ ਹੋਜੇ ਬਟ ਜਿਹੜੇ ਹੈਡਮੇਡ ਹੁੰਦੇ ਹਨ ਸਾਨੂੰ ਉਹਨਾਂ ਦੀ ਪੂਰੀ ਕੋਐਲਟੀਜ਼ ਹਰ ਇੱਕ ਚੀਜ਼ ਦਾ ਪਤਾ ਹੁੰਦਾ ਹੈ ਕਿ ਅਸੀਂ ਕਿਵੇਂ ਬਣਵਾਈ ਹੈ ਕਿਵੇਂ ਨਹੀਂ ਤੇ ਸਾਨੂੰ ਓਲਵੇਜ ਉਹ ਚੀਜ਼ 'ਤੇ ਬੜਾ ਹੀ ਤਲੱਕ ਤਰੱਕੀ ਬਖਸ਼ਿਸ ਨਾਲ਼ ਉਹਦੇ 'ਤੇ ਕੰਮ ਕੀਤਾ ਜਾਂਦਾ ਹੈ